ਪੁਰਾਣੇ ਸਮੇਂ ਅਤੇ ਹੁਣ ਦੀ ਟੈਕਨੋਲੋਜੀ ਵਿੱਚ ਬਹੁਤ ਅੰਤਰ ਹੈ ਇਹ ਨਵੀਂ ਟੈਕਨੋਲੋਜੀ ਸਾਡੇ ਬਹੁਤ ਕੰਮ ਆਉਂਦੀ ਹੈ ਅੱਜ ਕੱਲ੍ਹ ਸਾਨੂੰ ਸਿੱਖਿਆ ਲੈਣ ਲਈ ਆਨਲਾਈਨ ਕਲਾਸਿਸ ਵੀ ਲੈ ਸਕਦੇ ਹਾਂ ਬਲਕਿ ਸਾਨੂੰ ਪਹਿਲਾਂ ਜਾ ਕੇ ਉੱਥੇ ਸਕੂਲ ਜਾ ਕੇ ਹੀ ਸਿੱਖਿਆ ਲੈਣੀ ਪੈਂਦੀ ਸੀ ਹੁਣ ਆਪਾਂ ਕਾਫ਼ੀ ਕੁਛ ਕਰ ਸਕਦੇ ਹਾਂ ਆਨਲਾਈਨ ਨਾਲ ਆਪਾਂ ਜਿਵੇਂ ਆਨਲਾਈਨ ਪੇਮੈਂਟ ਕਰ ਸਕਦੇ ਹਾਂ ਉਸ ਨਾਲ ਸਾਨੂੰ ਕੈਸ਼ ਰੱਖਣ ਦੀ ਕੋਈ ਸਿਰ ਦਰਦੀ ਨਹੀਂ ਹੁੰਦੀ ਹੈ ਆਪਾਂ ਜਿੱਥੇ ਵੀ ਜਾਣਾ ਹੈ ਇੱਕ ਸਕੈਨ ਹੁੰਦਾ ਹੈ ਉਸਤੋਂ ਸਕੈਨ ਕਰਕੇ ਆਪਾਂ ਪੈਸੇ ਪਾ ਸਕਦੇ ਹਾਂ ਹੁਣ ਆਪਾਂ ਆਨਲਾਈਨ ਦੇ ਜ਼ਰੀਏ ਕਾਫ਼ੀ ਜੋਬਸ ਨੂੰ ਵੀ ਅਪਲਾਈ ਕਰ ਸਕਦੇ ਹਾਂ ਨਹੀਂ ਤਾਂ ਸਾਨੂੰ ਪਹਿਲਾਂ ਜਾ ਕੇ ਹੀ ਉੱਥੇ ਅਪਲਾਈ ਕਰਨਾ ਪੈਂਦਾ ਸੀ ਜੋ ਕਿ ਬਹੁਤ ਹੀ ਟਾਈਮ ਖ਼ਰਾਬੀ ਹੁੰਦਾ ਸੀ ਅੱਜ ਕੱਲ੍ਹ ਆਪਾਂ ਆਨਲਾਈਨ ਸ਼ੋਪਿੰਗ ਵੀ ਕਰ ਸਕਦੇ ਹਾਂ ਟੈਕਨੋਲਜੀ ਦੇ ਜ਼ਰੀਏ ਇਸ ਨਾਲ ਸਾਨੂੰ ਉੱਥੇ ਧੱਕਾ ਮੁੱਕੀ ਵੀ ਨਹੀਂ ਮਿਲਦੀ ਹੈ ਜਿੱਦਾਂ ਕਿ ਪੁਰਾਣੇ ਸਮੇਂ ਵਿੱਚ ਮਿਲਦੀ ਸੀ ਉੱਥੇ ਜਾ ਕੇ ਅੱਜ ਕੱਲ੍ਹ ਬਹੁਤ ਹੀ ਵਧੀਆ ਟੈਕਨੋਲੋਜੀ ਆ ਗਈ ਹੈ ਹੁਣ ਆਉਣ ਵਾਲੇ ਯੁੱਗ ਵਿੱਚ ਏ ਆਈ ਰੋਬੋਟਸ ਇਹ ਸਭ ਵੀ ਆਉਣਗੇ ਜਿੱਦਾਂ ਕਿ ਆਪਾਂ ਦੇਖ ਸਕਦੇ ਹਾਂ